ਸਿਰ ਦਰਦ ਦੇ ਇਲਾਜ ਲਈ ਬਹੁਤ ਘਰੇਲੂ ਨੁਸਖੇ ਹਨ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਟੈਨਸ਼ਨ ਲੈਣ ਦੇ ਕਾਰਨ ਸਿਰ ਦਰਦ ਕਰਨ ਲੱਗ ਪੈਂਦਾ ਹੈ ਸਾਡਾ ਤਾਂ ਸਾਨੂੰ ਡਾਕਟਰ ਕੋਲੋਂ ਸਿਰ ਦਰਦ ਦੀ ਦਵਾਈ ਲੈਣੀ ਪੈਂਦੀ ਹੈ ਜਿੱਦਾਂ ਕਿ ਪੈਰਾਸੀਟਾਮੋਲ ਜਾਂ ਡਾਕਟਰ ਕਹਿੰਦੇ ਵੀ ਰੈਸਟ ਕਰੋ ਆਦਿ ਕੁਛ ਕਰਦੇ ਹਾਂ ਸਾਨੂੰ ਚਾਹ ਪੀਣ ਦੇ ਨਾਲ਼ ਵੀ ਸਿਰ ਦਰਦ ਠੀਕ ਹੋ ਜਾਂਦਾ ਹੈ ਅਤੇ ਰੈਸਟ ਕਰਨ ਦੇ ਨਾਲ਼ ਵੀ ਸਾਡਾ ਸਿਰ ਦਰਦ ਹਟ ਜਾਂਦਾ ਹੈ